ਹਾਂ ਮੈਨੂੰ ਇੱਕ ਪ੍ਰੋਜੈਕਟ ਇੱਦਾਂ ਦਾ ਮਿਲਿਆ ਸੀ ਕਾਲਜ ਤੋਂ ਜਿਸ ਵਿੱਚ ਮੈਂ ਸਾਰਾ ਕੁਛ ਬਿਆਨ ਕਰਨਾ ਸੀ ਕਿ ਉਸ ਦੇ ਵਿੱਚ ਉਦਾਸੀ ਸਭ ਦੀ ਹੱਸੀ ਸਭ ਤਰ੍ਹਾਂ ਦੇ ਇਮੋਸ਼ਨਸ ਉਹਦੇ ਵਿੱਚ ਹੋਣ ਜਿਵੇਂ ਕਿ ਅੰਧਕਾਰ ਖੁਸ਼ੀ ਗਮੀ ਸਭ ਕੁਝ ਉਸ ਦੇ ਵਿੱਚ ਹੋਵੇ ਅਤੇ ਇਸ ਟਾਈਮ ਮੈਨੂੰ ਬਹੁਤ ਹੀ ਪਜਲ ਹੋਈ ਮੈਨੂੰ ਕੁਛ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇੱਕੋ ਚਿੱਤਰ ਵਿੱਚ ਕਿਵੇਂ ਸਾਰਾ ਕੁਛ ਕਰਾਂ ਫਿਰ ਮੈਂ ਆਪਣੇ ਟੀਚਰਸ ਦੀ ਜਿਹੜੇ ਫਰੈਂਡਸ ਮੇਰੇ ਡਰੋਇੰਗ ਵਿੱਚ ਵਧੀਆ ਨੇ ਜਾਂ ਜਿਹਨਾਂ ਨੂੰ ਡਰਾਇੰਗ ਵਿੱਚ ਇੰਟਰਸਟ ਹੈ ਮੈਂ ਉਹਨਾਂ ਤੋਂ ਪੁੱਛਿਆ ਇਹ ਸਭ ਦਾ ਉਹਨਾਂ ਨੇ ਮੇਰੀ ਬਹੁਤ ਮਦਦ ਕੀਤੀ ਕਿ ਕਿਸੇ ਬੱਚੇ ਨੂੰ ਉਦਾਸੀ ਵਾਲਾ ਚਿਹਰਾ ਜਾਂ ਕਿਸੇ ਨੂੰ ਹੱਸੀ ਵਾਲਾ ਚਿਹਰਾ ਇੱਦਾਂ ਕੁਛ ਨਾ ਕੁਛ ਬਣਾ ਦੇ ਮੈਂ ਉਸ ਟਾਈਪ ਦਾ ਸਾਰਾ ਕੁਝ ਬਣਾਇਆ ਇਸ ਤਰ੍ਹਾਂ ਮੇਰੀ ਚਿੱਤਰ ਵਿੱਚ ਸਭ ਕੁਝ ਸ਼ੋਅ ਹੋ ਰਿਹਾ ਸੀ ਕੋਈ ਵੀ ਮੇਰਾ ਚਿੱਤਰ ਦੇਖਦਾ ਸੀ ਤਾਂ ਉਸਨੂੰ ਸਾਰੇ ਈਮੋਸ਼ਨਸ ਹੀ ਨਜ਼ਰ ਆਉਂਦੇ ਸੀ ਸਭ ਕਹਿੰਦੇ ਸੀ ਕਿ ਇਹ ਚਿੱਤਰ ਬਹੁਤ ਵਧੀਆ ਬਣਿਆ